ਸਾਡਾ ਸਮਾਜ ਉਹਨਾਂ ਔਰਤਾਂ ਦਾ ਸਮਰਥਨ ਨਹੀਂ ਕਰਦਾ ਜੋ ਡਾਂਸ ਨੂੰ ਇੱਕ ਸ਼ੌਂਕ ਦੇ ਤੌਰ 'ਤੇ ਜਾਰੀ ਰੱਖਣਾ ਚਾਹੁੰਦੇ ਹਨ ਕਈ ਔਰਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਕਿ ਆਪਣੇ ਸ਼ੌਂਕ ਲਈ ਹੀ ਨੱਚਦੀਆਂ ਹਨ ਅਤੇ ਅੱਗੇ ਪੱਧਰ 'ਤੇ ਪਹੁੰਚਦੀਆਂ ਹਨ ਕਈ ਔਰਤਾਂ ਹੁੰਦੀਆਂ ਹਨ ਜੋ ਕਿ ਇਵੇਂ ਵਿਆਹ ਸ਼ਾਦੀਆਂ ਵਿੱਚ ਹੀ ਨੱਚਣਾ ਪਸੰਦ ਕਰਦੀਆਂ ਹਨ ਪਰ ਕਈ ਔਰਤਾਂ ਆਪਣੇ ਰੋਜ਼ੀ ਰੋਟੀ ਕਮਾਉਣ ਲਈ ਬਾਹਰ ਸਟੇਜਾਂ 'ਤੇ ਜਾਂ ਵਿਆਹ ਸ਼ਾਦੀਆਂ ਵਿੱਚ ਸਾਰੇ ਲੋਕਾਂ ਦੇ ਸਾਹਮਣੇ ਨੱਚਦੀਆਂ ਹਨ ਉਹਨਾਂ ਮਹਿਲਾਵਾਂ ਦਾ ਸਮਾਜ ਸਮਰਥਨ ਕਰਦਾ ਹੈ ਉਹ ਸਮਾਜ ਇਹਨਾਂ ਲੋਕਾਂ ਨੂੰ ਇਹਨਾਂ ਔਰਤਾਂ ਨੂੰ ਚੰਗਾ ਨਹੀਂ ਸਮਝਦਾ ਜਿਹੜੀਆਂ ਨੱਚਣ ਵਾਲੀਆਂ ਔਰਤਾਂ ਹੁੰਦੀਆਂ ਹਨ ਉਹਨਾਂ ਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹਨ ਕਈ ਵਾਰੀ ਇਹਨਾਂ ਔਰਤਾਂ ਨਾਲ ਬਾਹਰ ਛੇੜਖਾਨੀਆਂ ਹੋ ਜਾਂਦੀਆਂ ਹਨ ਕਈਆਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਬਹੁਤ ਕੁਝ ਇਹਨਾਂ ਔਰਤਾਂ ਨੂੰ ਸੁਣਨਾ ਪੈਂਦਾ ਹਾਂ ਪਰ ਫਿਰ ਵੀ ਉਹ ਕਈ ਆਪਨੇ ਸ਼ੌਂਕ ਲਈ ਹੀ ਨੱਚਦੀਆਂ ਹਨ ਪਰ ਕਈ ਆਪਣੇ ਰੋਜ਼ੀ ਰੋਟੀ ਕਮਾਉਣ ਲਈ ਇਹ ਸਭ ਕਰਦੀਆਂ ਹਨ